ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਜੀ ਯੋਗਾ ਟੀਚਰ ਬੋਲ ਰਹੇ ਹੋ ਜੀ ਸਰ ਮੈਂ ਨਾ ਯੋਗਾ ਦੀ ਕਲਾਸ ਲੈਣੀ ਸੀਗੀ ਅਤੇ ਤੁਸੀਂ ਮੈਨੂੰ ਕਿਹੜੇ ਟਾਈਮ ਹੈਗਾ ਅਤੇ ਕਿੰਨੀ ਫੀਸ ਹੈਗੀ ਹੈ ਸਾਰਾ ਕੁਝ ਦੱਸ ਸਕਦੇ ਹੋ ਸਰ ਹਾਂਜੀ ਸਰ ਹਾਂਜੀ ਸਰ ਅੱਛਾ ਛੇ ਤੋਂ ਅੱਠ ਸਰ ਅਤੇ ਸਰ ਮ ਫੀਸ ਕਿੰਨੀ ਹੋਵੇਗੀ ਸਰ ਪੰਦਰਾਂ ਸੌ ਸਰ ਇਹ ਪੰਦਰਾਂ ਸੌ ਫਿਕਸ ਹੈ ਜਾਂ ਇਸ ਤੋਂ ਘੱਟ ਵੱਧ ਹੋ ਸਕਦੀ ਹੈ ਸਰ ਸਰ ਫਿਰ ਸਰ ਤੁਸੀਂ ਕਿੰਨਾ ਟਾਈਮ ਕਰਵਾਓਗੇ ਸਰ ਮਤਲਬ ਮਹੀਨਾ ਦੋ ਮਹੀਨਾ ਸਰ ਮੇਰੀ ਥਰਟੀ ਫੋਰ ਏਜ ਹੈ ਸਰ ਅਤੇ ਉਸ ਹਿਸਾਬ ਨਾਲ ਕਿਹੜੀਆਂ ਕਿਹੜੀਆਂ ਮਤਲਬ ਐਕਸਰਸਾਈਜ਼ ਮੈਨੂੰ ਵਧੀਆ ਰਹਿਣਗੀਆਂ ਉਸ ਹਿਸਾਬ ਨਾਲ ਦੱਸ ਦਓ ਸਰ ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਸਰ ਮਤਲਬ ਜਿਹੜੇ ਤੁਹਾਡੇ ਇਹ ਬੈਚ ਹੈਗੇ ਆ ਤਿੰਨ ਅਤੇ ਜੇ ਮੈਨੂੰ ਮਤਲਬ ਥੋੜ੍ਹਾ ਬਹੁਤ ਇਹਨਾਂ 'ਚ ਐਡਜਸਟ ਕਰਨਾ ਪਵੇ ਤਾਂ ਹੋ ਸਕਦਾ ਸਰ ਕਿਉਂਕਿ ਨਾ ਸਰ ਮੈਂ ਸਟੂਡੈਂਟ ਹੈਗਾ ਅਤੇ ਪਹਿਲਾਂ ਮੈਂ ਪੜ੍ਹਨ ਵੀ ਜਾਣਾ ਹੁੰਦਾ ਜੀ ਫਿਰ ਉਸ ਹਿਸਾਬ ਨਾਲ ਆਪਣਾ ਸ਼ੈਡਿਊਲ ਸਾਰਾ ਸੈੱਟ ਕਰਨਾ ਹੁੰਦਾ ਸਰ ਸਰ ਤਿੰਨ ਵਜੇ ਤੱਕ ਤਾਂ ਮੇਰਾ ਸਕੂਲ ਹੁੰਦਾ ਸਰ ਓ ਸਕੂਲ ਕੋਲਜ ਸਰ ਅਤੇ ਉਸ ਤੋਂ ਬਾਅਦ ਸਰ ਅਤੇ ਛੇ ਵਜੇ ਮੈਂ ਵਾਪਿਸ ਨਹੀ ਆ ਸਕਦਾ ਛੇ ਤੋਂ ਅੱਠ ਫਿਰ ਮੈਂ ਜ਼ਿਆਦਾ ਲੇਟ ਹੋ ਜਾਂਦਾ ਸਰ ਘਰ ਵੀ ਆਉਣਾ ਹੁੰਦਾ ਇਹ ਕੋਈ ਹਾਂਜੀ ਚਾਰ ਤੋਂ ਛੇ ਦਾ ਟਾਈਮ ਜੇ ਹੋ ਸਕੇ ਤਾਂ ਸਰ ਹਾਂਜੀ ਸਰ ਅਤੇ ਸਰ ਅਤੇ ਸਰ ਆਪਣੇ ਮਤਲਬ ਕਿੰਨੇ ਸਟੂਡੈਂਟ ਹੁੰਦੇ ਆ ਇੱਕ ਇੱਕ ਬੈਚ 'ਚ ਅੱਛਾ ਵੀਹ ਵੀਹ ਬੱਚੇ ਅਤੇ ਇਹ ਓਨਲੀ ਮੈਨਸ ਹੁੰਦਾ ਜਾਂ ਜੈ ਲੇਡੀਜ਼ ਦੀ ਸ ਨਾਲ ਹੁੰਦੇ ਸਰ ਅੱਛਾ ਜੀ ਅੱਛਾ ਇਕੱਠੇ ਹੀ ਹੁੰਦੇ ਆ ਠੀਕ ਹੈ ਸਰ ਅਤੇ ਬਾਕੀ ਸਰ ਮਤਲਬ ਜੇ ਅਸੀਂ ਤਿੰਨ ਚਾਰ ਜਣੇ ਇਕੱਠੇ ਆਈਏ ਤਾਂ ਕੁਛ ਲੈੱਸ ਹੋਵੇਗਾ ਸਰ ਜਾਂ ਇੱਕੋ ਹੀ ਰੇਟ ਲੱਗਣਾ ਸਰ ਹਾਂਜੀ ਸਰ ਕਿਉਂਕਿ ਮੈਂ ਮੇਰੇ ਤਿੰਨ ਚਾਰ ਫਰੈਂਡ ਹੋਰ ਹੈਗੇ ਆ ਫਿਰ ਮੈਂ ਸੋਚਦਾ ਸੀ ਅਸੀਂ ਇਕੱਠੇ ਹੀ ਲੱਗ ਜਾਈਏ ਅੱਛਾ ਸਰ ਸਰ ਜਿਵੇਂ ਮੈਨੂੰ ਇਕੱਲੇ ਨੂੰ ਕਰੂੰਗਾ ਜਾਂ ਉਹ ਤਿੰਨਾਂ ਚਾਰਾਂ ਦੀ ਫੀਸ 'ਚੋਂ ਦੋ ਸੌ ਦੋ ਸੌ ਕਟਾ ਕਟਾਓਗੇ ਚੱਲੋ ਠੀਕ ਹੈ ਸਰ ਅਤੇ ਫਿਰ ਸਰ ਮੈਂ ਕਦੋਂ ਜੁਆਇਨ ਕਰਾਂ ਤੁਸੀਂ ਮੈਨੂੰ ਦੱਸ ਦਿਓ ਵੀ ਪਰਸੋਂ ਤੋਂ ਸਰ ਅਤੇ ਸਰ ਹਫ਼ਤੇ ਦੇ ਸੱਤੋ ਦਿਨ ਮਤਲਬ ਆਉਣਾ ਹੈ ਜਾਂ ਵਿਚਾਲੇ ਛੁੱਟੀ ਹੁੰਦੀ ਹੈ ਕੋਈ ਸੰਡੇ ਛੁੱਟੀ ਹੁੰਦੀ ਸੰਡੇ ਸੰਡੇ ਬੰਦ ਰਹਿੰਦਾ ਬਾਕੀ ਮਤਲਬ ਛੇ ਦਿਨ ਹਾਂਜੀ ਠੀਕ ਹੈ ਸਰ ਮੈਂ ਫਿਰ ਤੁਹਾਨੂੰ ਉਹ ਮੇਰੇ ਦੋਸਤਾਂ ਨਾਲ ਸਲਾਹ ਕਰਕੇ ਤੁਹਾਨੂੰ ਦੁਬਾਰਾ ਕੋਲ ਕਰਕੇ ਸਾਰਾ ਕੁਝ ਬਾਇਓਡਾਟਾ ਆਪਣਾ ਦੱਸ ਕੇ ਅਤੇ ਸ਼ੁਰੂ ਕਰ ਦਿੰਦੇ ਹਾਂ ਸਰ ਕਲਾਸ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਸਰ ਹਾਂਜੀ ਸਰ ਓਕੇ ਜੀ ਧੰਨਵਾਦ ਓਕੇ ਸਰ